ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਮ ਮੈਂ ਗੀਤਾਂਜਲੀ ਸ਼ਰਮਾ ਬੋਲਦੀ ਮੈਮ ਮੈਨੂੰ ਮੇਰੀ ਫਰੈਂਡ ਸਮਰਿਤੀ ਨੇ ਦੱਸਿਆ ਸੀਗਾ ਕਿ ਤੁਸੀਂ ਡਾਂਸ ਸਿਖਾਉਂਦੇ ਹੋ ਹਾਂਜੀ ਹਾਂਜੀ ਮੈਨੂੰ ਵੀ ਉਹਨਾਂ ਨੇ ਹੀ ਦੱਸਿਆ ਸੀ ਅਤੇ ਮੈਮ ਇਹਦੀ ਫੀਸ ਕੀ ਹੈ ਹਾਂਜੀ ਅਤੇ ਟਾਈਮਿੰਗ ਵਗੈਰਾ ਕਿਵੇਂ ਹਾਂਜੀ

ਮੈਨੂੰ ਸਵੇਰ ਦਾ ਹੀ ਟਾਈਮ ਬੈਸਟ ਹੈ ਕਿਉਂਕਿ ਫਿਰ ਮੈਂ ਆਪਣੀ ਕੋਚਿੰਗ ਕਲਾਸ ਵੀ ਲਗਾਉਣੀ ਹੁੰਦੀ ਹੈ ਇਸ ਲਈ ਅਤੇ ਬਾਕੀ ਹਾਂਜੀ ਮੈਂ ਔਨਲਾਈਨ ਕੋਚਿੰਗ ਲੈਂਦੀ ਹੈ ਨਾ ਇਸ ਲੀਏ ਅਤੇ ਬਾਕੀ ਹਾਂਜੀ ਹਾਂਜੀ ਮੈਮ ਅਤੇ ਬਾਕੀ ਤੁਹਾਨੂੰ ਮੈਂ ਡਿਸਾਈਡ ਕਰਕੇ ਦੱਸ ਦੂੰਗੀ ਅਤੇ ਫਿਰ ਤੁਹਾਨੂੰ ਬੈਕ ਕਾਲ ਕਰੂੰਗੀ ਹਾਂਜੀ ਹਾਂਜੀ ਓਕੇ ਮੈਮ ਥੈਂਕ ਯੂ ਓਕੇ